ਅੱਜ ਕੱਲ੍ਹ ਦੇ ਦੌਰ ਵਿੱਚ ਬੱਚੇ ਸਕਰੀਨ ਦੇਖਣਾ ਬਹੁਤ ਜ਼ਿਆਦਾ ਪਸੰਦ ਕਰਦੇ ਆ ਮੋਬਾਈਲ ਦੀ ਵਰਤੋਂ ਬਹੁਤ ਜ਼ਿਆਦਾ ਹੋ ਗਈ ਆ ਬੱਚੇ ਪੂਰਾ ਪੂਰਾ ਦਿਨ ਫ਼ੋਨ ਵਿੱਚ ਗੇਮਾਂ ਖੇਡਦੇ ਆ ਜਾਂ ਵੀਡੀਓ ਦੇਖਦੇ ਆ ਜਿਸ ਨਾਲ ਉਹਨਾਂ ਦੇ ਸਰੀਰਕ ਦਾ ਅਤੇ ਦਿਮਾਗ ਦਾ ਵਿਕਾਸ ਨਹੀਂ ਹੋ ਰਿਹਾ ਉਹ ਕਾਫੀ ਜ਼ਿੱਦਲ ਹੋ ਰਹੇ ਆ ਜਿਸ ਨਾਲ ਉਹਨਾਂ ਦੇ ਹੀ ਮਾਂ ਪਿਓ ਬਹੁਤ ਪ੍ਰੇਸ਼ਾਨ ਰਹੇ ਆ ਬੱਚੇ ਅੱਜ ਕੱਲ੍ਹ ਹਮੇਸ਼ਾ ਹੀ ਗੇਮਾਂ ਖੇਡਦੇ ਰਹਿੰਦੇ ਆ ਬਸ ਫ਼ੋਨ 'ਤੇ ਹੀ ਖੇਡਣਾ ਪਸੰਦ ਕਰਦੇ ਆ ਸਾਨੂੰ ਉਹਨਾਂ ਨੂੰ ਸਰੀਰਕ ਤੌਰ 'ਤੇ ਗੇਮਾਂ ਖੇਡਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਜਿਸ ਲਈ ਸਾਨੂੰ ਹੀ ਕੋਈ ਉਪਰਾਲੇ ਕਰਨੇ ਚਾਹੀਦੇ ਹਨ ਸਾਨੂੰ ਖੁਦ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ ਹੈ ਅਸੀਂ ਉਹਨਾਂ ਦੇ ਨਾਲ ਖੇਡਾਂਗੇ ਤਾਂ ਹੀ ਤਾਂ ਉਹ ਪ੍ਰੇਰਿਤ ਹੋਣਗੇ ਉਹਨਾਂ ਦੇ ਨਾਲ ਖ ਵੱਖਰੇ ਵੱਖਰੇ ਤਰੀਕਿਆਂ ਨਾਲ ਖੇਡਣਾ ਚਾਹੀਦਾ ਹੈ ਸਾਨੂੰ ਆਪਣਾ ਫ਼ੋਨ ਵੀ ਦੇਖਣਾ ਬੰਦ ਕਰਨਾ ਪਵੇਗਾ ਤਾਂ ਹੀ ਅਸੀਂ ਉਹਨਾਂ ਨੂੰ ਰੋਕ ਸਕਦੇ ਹਾਂ ਸਾਨੂੰ ਬੱਚਿਆਂ ਨੂੰ ਟਾਈਮ ਦੇਣਾ ਪਵੇਗਾ ਤਾਂ ਹੀ ਖੇਡਣ ਲਈ ਉਹਨਾਂ ਨੂੰ ਅਸੀਂ ਪ੍ਰੇਰਿਤ ਕਰ ਸਕਦੇ ਹਾਂ